ਹਾਂ ਮੈਂ ਇੱਕ ਵਾਰ ਦਿੱਲੀ ਗਿਆ ਸੀ ਉਦੋਂ ਦਿੱਲੀ ਜਾਣ ਸਮੇਂ ਮੈਨੂੰ ਉੱਥੇ ਜਦੋਂ ਅਸੀਂ ਘੁੰਮਣ ਗਏ ਲਾਲ ਕਿਲ੍ਹਾ ਗਏ ਇੰਡੀਆ ਗੇਟ ਗਏ ਜਦੋਂ ਉੱਥੇ ਕੁਛ ਲੋਕ ਰੇੜੀਆਂ ਵਗੈਰਾ ਲਗਾ ਕੇ ਰੱਖਦੇ ਆ ਕੁਛ ਖਾਣ ਪੀਣ ਦੀਆਂ ਚੀਜ਼ਾਂ ਜਿਨ੍ਹਾਂ ਤੋਂ ਮਿਲ ਜਾਂਦੀਆਂ ਜ਼ਿਆਦਾਤਰ ਉਹ ਹਿੰਦੀ 'ਚ ਗੱਲ ਕਰਦੇ ਹਾਂ ਜਾਂ ਟੂਰਿਸਟ ਲੋਕ ਆਏ ਹੁੰਦੇ ਹਾਂ ਇੰਗਲਿਸ਼ 'ਚ ਗੱਲ ਕਰਦੇ ਹਾਂ ਅ ਮਤਲਬ ਜਿੰਨੀ ਕੁ ਮੈਨੂੰ ਹਿੰਦੀ ਆਉਂਦੀ ਹੈ ਮੈਂ ਬੋਲ ਸਕਦਾ ਉੱਨੀ ਕੁ ਉਹਨਾਂ ਨਾਲ ਹਿੰਦੀ 'ਚ ਮੈਂ ਗੱਲ ਕੀਤੀ ਜਾ ਫਿਰ ਮੈਂ ਗੂਗਲ ਦੀ ਗੂਗਲ 'ਚ ਟਰਾਂਸਲੇਟ ਕਰਕੇ ਵੀ ਉਹਨਾਂ ਨਾਲ ਗੱਲ ਕਰਦਾ ਰਿਹਾ ਕੁਛ ਟੂਰਿਸਟ ਆਉਂਦੇ ਹੈ ਤਾਂ ਉਨ੍ਹਾਂ ਨਾਲ ਆਪਾਂ ਉਹ ਸਾਨੂੰ ਇੰਗਲਿਸ਼ 'ਚ ਬੋਲਦੇ ਹੈ ਫਿਰ ਉਹਨੂੰ ਆਪਾਂ ਡੱਬ ਕਰਕੇ ਗੂਗਲ ਟਰਾਂਸਲੇਟ ਦੇ ਵਿੱਚ ਫੇਰ ਉਨ੍ਹਾਂ ਨਾਲ ਮੈਂ ਗੱਲ ਕਰਦਾ ਮਤਲਬ ਇੱਦਾਂ ਹੋ ਜਾਂਦੀ ਅਸਾਨੀ ਲੱਗਦੀ ਹੈ ਥੋੜ੍ਹੀ ਜਿਹੀ ਕੁਛ ਵਰਡ ਇੱਦਾਂ ਦੇ ਕੁਛ ਉਹਨਾਂ ਦੀਆਂ ਗੱਲਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਸਾਨੂੰ ਸਮਝ ਨਹੀਂ ਲੱਗਦੀਆਂ ਆਪਾਂ ਉਹਨਾਂ ਨੂੰ ਜਵਾਬ ਨਹੀਂ ਦੇ ਸਕਦੇ ਉੱਤਰ ਨਹੀਂ ਦੇ ਸਕਦੇ ਤਾਂ ਫਿਰ ਉਹ ਗੂਗਲ ਟਰਾਂਸਲੇਟ ਦੀ ਵਰਤੋਂ ਕਰਕੇ ਆਪਾਂ ਥੋੜ੍ਹੀ ਜਿਹੀ ਆਸਾਨੀ ਹੋ ਜਾਂਦੀ ਹੈ